ਕੁਝ ਸਾਲ ਪਹਿਲਾਂ ਟਾਈਗਰ ਨਾਮ ਦੀ ਮਸ਼ੀਨ ਮੈਂ ਨਾਨਕਪੁਰੇ ਤੋਂ ਅੰਬਰੇਲਾ ਮਸ਼ੀਨ ਛੇ ਹਜ਼ਾਰ ਰੁਪਏ ਦੀ ਲਿਆਂਦੀ ਸੀ ਇਹ ਬਹੁਤ ਚੰਗੀ ਚੱਲਦੀ ਹੈ ਇਸ ਨਾਲ ਬਹੁਤ ਸਿਲਾਈ ਸੋਹਣੀ ਹੁੰਦੀ ਹੈ ਇਹ ਹਰੇਕ ਕੱਪੜੇ ਉੱਤੇ ਚੱਲ ਜਾਂਦੀ ਹੈ ਇਸ ਨਾਲ ਬਹੁਤ ਸੂਟ ਸਿਲਾਈ ਕੀਤੇ ਹਨ ਇਹ ਪੈਰਾਂ ਨਾਲ ਵੀ ਚੱਲ ਜਾਂਦੀ ਹੈ ਅਤੇ ਮੋਟਰ ਨਾਲ ਵੀ ਚੱਲ ਜਾਂਦੀ ਹੈ ਇਸ ਨਾਲ ਕਮਰ ਵੀ ਦਰਦ ਨਹੀਂ ਕਰਦੀ ਅਤੇ ਸਰਵਾਈਕਲ ਵੀ ਨਹੀਂ ਹੁੰਦਾ ਮੇਰਾ ਬਹੁਤ ਮਨ ਲੱਗਦਾ ਹੈ ਮੇਰਾ ਦਿਲ ਕਰਦਾ ਹੈ ਮੈਂ ਰਾਤ ਨੂੰ ਵੀ ਸਿਲਾਈ ਕਰੀ ਜਾਵਾਂ ਇਹ ਬਹੁਤ ਆਰਾਮਦੇਹ ਹੈ ਬਹੁਤ ਸਿਲਾਈ ਚੰਗੀ ਕਰਦੀ ਹੈ